ਹਾਂਜੀ ਖਾਣਾ ਬਣਾਉਣਾ ਸਕੂਲ ਵਿੱਚ ਸਿਖਾਉਂਦੇ ਤਾਂ ਨਹੀਂ ਜ਼ਿਆਦਾਤਰ ਸਕੂਲਾਂ ਵਿੱਚ ਇਹ ਕੰਮ ਹੀ ਨਹੀਂ ਕਰਾਇਆ ਜਾਂਦਾ ਬਾਕੀ ਆਉਣ ਵਾਲੇ ਟਾਈਮ 'ਚ ਸਕੂਲ 'ਚ ਵੀ ਖਾਣਾ ਬਣਾਉਣ ਦਾ ਇੱਕ ਵਿਸ਼ਾ ਹੋਣਾ ਚਾਹੀਦਾ ਹੈ ਕਿਉਂਕਿ ਅੱਜ ਕੱਲ੍ਹ ਸਾਰੀ ਯੁਵਾ ਪੀੜ੍ਹੀ ਕਮਾਉਣ ਵਿੱਚ ਲੱਗੀ ਹੋਈ ਹੈ ਕਦੀ ਕੋਈ ਭਾਵੇਂ ਕੁੜੀਆਂ ਹੋਣ ਭਾਵੇਂ ਮੁੰਡੇ ਉਹਨਾਂ ਨੂੰ ਖਾਣਾ ਬਣਾਉਣਾ ਆਉਣਾ ਚਾਹੀਦਾ ਹੈ ਔਰ ਸਕੂਲ ਵਿੱਚ ਇੱਕ ਸਬਜੈਕਟ ਲਗਾਉਣਾ ਚਾਹੀਦਾ ਹੈ ਕਿਉਂਕਿ ਕਦੀ ਘਰ 'ਚ ਕੋਈ ਵੀ ਇੱਦਾਂ ਦੀ ਆ ਜਾਂਦੀ ਹੈ ਘਰ 'ਚ ਕੋਈ ਮਾਂ ਬਿਮਾਰ ਹੈ ਜਾਂ ਕੋਈ ਨਹੀਂ ਘਰ 'ਚ ਘਰ ਖਾਣਾ ਬਣਾਉਣ ਵਾਲਾ ਜਾਂ ਮਾਂ ਪਿਓ ਤਾਂ ਘਰ ਨਹੀਂ ਹੈ ਬੱਚੇ ਨੂੰ ਆਪ ਹੀ ਬਣਾਉਣਾ ਪੈਂਦਾ ਜਾਂ ਅੱਜ ਕੱਲ੍ਹ ਬੱਚੇ ਯੁਵਾ ਪੀੜ੍ਹੀ ਹੈ ਔਰ ਖਾਣਾ ਬਣਾਉਣਾ ਬਾਹਰ ਕਮਾਉਣ ਜਾਂਦੇ ਹੈ ਤਾਂ ਉਹਨਾਂ ਨੂੰ ਖਾਣੇ ਦੀ ਬੜੀ ਪ੍ਰੋਬਲਮ ਆਉਂਦੀ ਹੈ ਚਾਹੇ ਕੋਈ ਕੁੜੀ ਹੋਵੇ ਚਾਹੇ ਕੋਈ ਮੁੰਡਾ ਲੇਕਿਨ ਉਹਨੂੰ ਥੋੜ੍ਹਾ ਇੰਨਾ ਕੁ ਤਾਂ ਆਉਣਾ ਚਾਹੀਦਾ ਕਿ ਜੇ ਘਰ 'ਚ ਕੋਈ ਪ੍ਰੋਬਲਮ ਹੈ ਤਾਂ ਉਹ ਖਾਣਾ ਬਣਾ ਸਕਣ ਆਪਣਾ ਪੇਟ ਭਰ ਸਕਣ ਅਤੇ ਮਾਂ ਪਿਓ ਨੂੰ ਵੀ ਬਿਮਾਰੀ ਵਿੱਚ ਖਿਲਾ ਸਕਣ ਇਸ ਕਰਕੇ ਸਕੂਲਾਂ ਦੇ ਵਿੱਚ ਖਾਣਾ ਬਣਾਉਣਾ ਜ਼ਰੂਰੀ ਕਰਨਾ ਚਾਹੀਦਾ ਹੈ ਕਿ ਉਹਨਾਂ ਨੂੰ ਸਿਖਾਉਣਾ ਚਾਹੀਦਾ ਹੈ ਜ਼ਿਆਦਾ ਨਾ ਸਹੀ ਥੋੜ੍ਹਾ ਜਿਹਾ ਤਾ ਬੱਚੇ ਨੂੰ ਇਹਦੇ ਵਿੱਚ ਆਉਣਾ ਚਾਹੀਦਾ ਹੈ ਕਿ ਉਹ ਘਰ ਨੂੰ ਦੇਖ ਸਕਣ ਬਾਹਰ ਜਾ ਕੇ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਏ ਔਰ ਉਹਨਾਂ ਨੂੰ ਕਿਸੇ ਦੇ ਮੂੰਹ ਵੱਲ ਨਾ ਦੇਖਣਾ ਪਵੇ ਉਹ ਆਪ ਵੀ ਆਪਣਾ ਢਿੱਡ ਭਰ ਸਕਣ ਅਤੇ ਆਪਣੇ ਮਾਂ ਪਿਓ ਦਾ ਜਾਂ ਭੈਣ ਭਰਾਵਾਂ ਦਾ ਵੀ ਢਿੱਡ ਭਰ ਸਕਣ ਇਸ ਕਰਕੇ ਆਉਂਦੇ ਟਾਈਮ 'ਚ ਸਰਕਾਰ ਨੂੰ ਚਾਹੀਦਾ ਹੈ ਕਿ ਸਕੂਲਾਂ ਦੇ ਵਿੱਚ ਖਾਣਾ ਬਣਾਉਣ ਦਾ ਵਿਸ਼ਾ ਵੀ ਹੋਣਾ ਚਾਹੀਦਾ ਹੈ ਤਾਂ ਕਿ ਬੱਚੇ ਨੂੰ ਥੋੜ੍ਹਾ ਬਹੁਤਾ ਸਿੱਖ ਕੇ ਆਪਣਾ ਆਪ ਕਰ ਸਕਣ ਆਪਣਾ ਪੇਟ ਭਰ ਸਕਣ ਉਹਨਾਂ ਨੂੰ ਦੂਜੇ ਦੇ ਮੂੰਹ ਵੱਲ ਨਾ ਦੇਖਣਾ ਪਵੇ ਬਾਕੀ ਖਾਣਾ ਬਣਾਉਣਾ ਹਰ ਇੱਕ ਇਨਸਾਨ ਨੂੰ ਆਉਣਾ ਚਾਹੀਦਾ ਇਹ ਨਹੀਂ ਕਿ ਇਕੱਲਾ ਕੁੜੀਆਂ ਨੂੰ ਮੁੰਡਿਆਂ ਲਈ ਵੀ ਇਹ ਵਿਸ਼ਾ ਜ਼ਰੂਰੀ ਹੋਣਾ ਚਾਹੀਦਾ ਹੈ